ਮੈਨੂੰ ਘੁੰਮਣਾ ਫਿਰਨਾ ਹਾਈਕਿੰਗ ਕਰਨਾ ਬਹੁਤ ਜ਼ਿਆਦਾ ਪਸੰਦ ਹੈ ਇਸ ਲਈ ਮੈਂ ਪਿਛਲੇ ਸਾਲ ਆ ਸ਼੍ਰੀ ਅਮਰਨਾਥ ਯਾਤਰਾ ਗਿਆ ਸੀ ਜਿਸ ਵਿੱਚ ਬਹੁਤ ਜ਼ਿਆਦਾ ਪਹਾੜ ਹੈ ਯਾਤਰਾ ਕਰਨੀ ਪੈਂਦੀ ਹੈ ਜਿਸ ਵਿੱਚ ਬਹੁਤ ਜ਼ਿਆਦਾ ਹਾਈਕਿੰਗ ਹੁੰਦੀ ਹੈ ਇਸ ਦੌਰਾਨ ਰਾਸਤੇ ਬਹੁਤ ਜ਼ਿਆਦਾ ਖ਼ਤਰਨਾਕ ਸੀ ਇਸ ਵਿੱਚ ਜਾਂਦੇ ਮੈਂ ਆਪਣੀ ਫੈਮਿਲੀ ਨਾਲ ਇੱਥੇ ਯਾਤਰਾ ਦਾ ਸਫ਼ਰ ਲੈਣ ਗਿਆ ਸੀ ਘੁੰਮਣ ਗਿਆ ਸੀ ਇਸ ਯਾਤਰਾ ਵਿੱਚ ਮੈਂ ਜਦੋਂ ਅਸੀਂ ਚੜ੍ਹਾਈ ਚੜ੍ਹ ਰਹੇ ਸੀ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਨੂੰ ਆਈਆਂ ਜਿਸ ਕਾਰਨ ਬਾਰਿਸ਼ ਬਹੁਤ ਜ਼ਿਆਦਾ ਤੇਜ਼ ਪੈ ਰਹੀ ਸੀ ਅਤੇ ਬਹੁਤ ਜ਼ਿਆਦਾ ਚਿੱਕੜ ਹੋ ਚੁੱਕਿਆ ਸੀ ਰਾਸਤੇ ਬਹੁਤ ਛੋਟੇ ਸੀ ਸਾਈਡ 'ਤੇ ਖਾਈ ਬਹੁਤ ਜ਼ਿਆਦਾ ਵੱਡੀ ਡੂੰਘੀ ਕਹਿਰੀ ਹੁੰਦੀ ਜਿਸ ਕਾਰਨ ਕਈ ਲੋਕ ਖਾਈ ਵਿੱਚ ਗਿਰ ਵੀ ਰਹੇ ਸੀ ਜੋ ਸਾਵਧਾਨੀਆਂ ਦਾ ਧਿਆਨ ਨਹੀਂ ਰੱਖ ਰਹੇ ਸੀ ਜਿਹਨਾਂ ਕਾਰਨ ਰਾਸ ਸਾਨੂੰ ਬਹੁਤ ਜ਼ਿਆਦਾ ਮੁਸ਼ਕਿਲਾਂ ਹੋਈਆਂ ਲੈਂਡ ਸਲਾਈਡਾਂ ਵੀ ਹੋ ਰਹੀਆਂ ਸੀ ਮੈਂ ਅਤੇ ਇਸ ਇਸੀ ਵੀ ਦੌਰਾਨ ਮੈਂ ਆਪਣੇ ਘਰਦਿਆਂ ਤੋਂ ਵਿੱਛੜ ਗਿਆ ਜਿਸ ਕਾਰਨ ਫਿਰ ਮੈਨੂੰ ਉੱਥੇ ਦੇ ਲੋਕਲਾਂ ਬੰਦਿਆਂ ਨੂੰ ਮੈਂ ਪੁੱਛ ਪੁੱਛ ਕੇ ਬੜੀ ਮੁਸ਼ਕਿਲ ਹੋਈ ਮੈਨੂੰ ਲੋਕਾਂ ਨਾਲ ਗੱਲ ਕਰਨਾ ਕਿਉਂਕਿ ਉਹਨਾਂ ਦੀ ਭਾਸ਼ਾ ਨਾਲੇ ਮੇਰੀ ਭਾਸ਼ਾ ਦਾ ਬਹੁਤ ਜ਼ਿਆਦਾ ਅਲੱਗ ਸੀ ਜਿਸ ਕਾਰਨ ਸਾਨੂੰ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਸਾਮ ਮੈਨੂੰ ਕਰ ਸਾਹਮਣਾ ਕਰਨਾ ਪਿਆ ਜਿਸ ਬੜੀ ਮੁਸ਼ਕਿਲ ਨਾਲ ਮੈਂ ਲੋਕਾਂ ਦੇ ਰਾਸਤਾ ਪੁੱਛ ਪੁੱਛ ਕੇ ਆਪਣੀ ਗੁਫ਼ਾ ਤੱਕ ਪੁੱਜਿਆ ਆਪਣੀ ਫੈਮਿਲੀ ਤੱਕ ਪੁੱਜਿਆ ਉਸ ਤੋਂ ਬਾਅਦ ਹੀ ਜਾ ਕੇ ਮੈਂ ਆਪਣੇ ਘਰਦਿਆਂ ਨੂੰ ਮਿਲ ਪਾਇਆ ਉਸ ਤੋਂ ਬਾਅਦ ਜਦੋਂ ਅਸੀਂ ਰਾਸ ਜਦੋਂ ਅਸੀਂ ਆਪਣਾ ਵਾਪਸ ਆ ਰਹੇ ਸੀ ਸਾ ਅਸੀਂ ਦੇਖਿਆ ਕਿ ਲੋਕ ਸਾਵਧਾਨੀਆਂ ਦਾ ਧਿਆਨ ਨਹੀਂ ਰੱਖ ਰਹੇ ਜਿਸ ਕਾਰਨ ਅਸੀਂ ਵੈਸੇ ਤਾਂ ਪੂਰੀ ਸਾਵਧਾਨੀਆਂ ਦਾ ਧਿਆਨ ਰੱਖਿਆ ਹੋਇਆ ਸੀ ਸਾਵਧਾਨੀਆਂ ਰੱਖਣ ਕਾਰਨ ਅਸੀਂ ਮੈਂ ਪੂਰਾ ਰੇਨ ਕੋਟ ਲੈਂਡਸਲਾਈਡ ਲਈ ਬਚਣ ਲਈ ਹਾਈਕਿੰਗ ਬੂਟਸ ਬੈਡ ਪੈਡਸ ਸਭ ਕੁਝ ਲਗਾ ਕੇ ਜਾ ਰਿਹਾ ਸੀ ਅਤੇ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਸੀ ਜਿਸ ਕਾਰਨ ਅਤੇ ਇੱਥੇ ਲੋਕਾਂ ਦੇ ਪੈਰ ਸ ਤਿਲਕਣ ਕਾਰਨ ਬਹੁਤ ਜ਼ਿਆਦਾ ਚੋਟਾਂ ਦੁਰਘਟਨਾ ਦੇ ਸਾਹਮਣਾ ਕਰਨਾ ਪੈ ਰਿਹਾ ਸੀ ਤਾਂ ਉੱਥੇ ਸਾਈਡ 'ਤੇ ਬੁਹਤ ਡੂੰਘੀ ਖਾਈ ਸੀ ਜਿਸ ਕਾਰਨ ਲੋਕਾਂ ਦੀਆਂ ਬੁਹਤ ਜ਼ਿਆਦਾ ਮੌਤਾਂ ਹੋ ਰਹੀਆਂ ਸੀ ਕਈ ਘੋੜਿਆਂ 'ਤੇ ਜਾ ਰਹੇ ਸੀ ਉਹ ਵੀ ਘੋੜੇ ਕਿਉਂਕਿ ਬਹੁਤ ਸਾਈਡ 'ਤੇ ਚਲਦੇ ਹਨ ਇਸ ਕਾਰਨ ਉਹ ਸਾਈਡ 'ਤੇ ਹੀ ਗਿਰ ਜਾ ਰਹੇ ਸੀ ਘੋੜੇ ਸਮੇਤ ਕਈ ਲੋਕ ਖਾਈਆਂ ਵਿੱਚ ਗਿਰ ਰਹੇ ਸੀ ਜਿਹਨਾਂ ਨੇ ਇਹ ਧਿਆਨ ਨਹੀਂ ਰੱਖਿਆ ਦੁਰਘਟਨਾਵਾਂ ਵਰਤਦੀਆਂ ਗਈਆਂ ਇਸ ਕਾਰਨ ਸਾਨੂੰ ਹਮੇਸ਼ਾ ਸਾਵਧਾਨੀਆਂ ਰੱਖਣੀਆਂ ਬਹੁਤ ਜ਼ਿਆਦਾ ਜ਼ਰੂਰੀ ਹਨ ਇਸ ਲਈ ਮੈਂ ਬਹੁਤ ਜ਼ਿਆਦਾ ਸਾਵਧਾਨੀ ਨਾਲ ਆਇਆ ਜਿਸ ਕਾਰਨ ਬਹੁਤ ਜ਼ਿਆਦਾ ਰਾਹ ਆਉਣ ਸਮੇਂ ਸਾਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜ਼ਿਆਦਾ ਸਾਵਧਾਨੀਆਂ ਕਰਨੀਆਂ ਚਾਹੀਦੀਆਂ ਹਨ ਕਿਉਂਕਿ ਉੱਥੇ ਲੈਂਡ ਸਲਾਈਡ ਹੋਣ ਦਾ ਬਹੁਤ ਜ਼ਿਆਦਾ ਖ਼ਤਰਾ ਹੁੰਦਾ ਹੈ ਕਿਉਂਕਿ ਉੱਥੇ ਬਾਰਿਸ਼ ਹਰ ਸਮੇਂ ਪੈਂਦੀ ਰਹਿੰਦੀ ਹੈ ਚਿੱਕੜ ਕਾਰਨ ਪੈਰ ਤਿਲਕਣ ਕੇ ਲੋਕ ਬਹੁਤ ਜ਼ਿਆਦਾ ਖਾਈਆਂ 'ਚ ਗਿਰਦੇ ਹਨ ਇਸ ਲਈ ਸਾਨੂੰ ਆਪਣੀ ਸਾਵਧਾਨੀਆਂ ਨਾਲ ਹੀ ਵਰਤਣਾ ਚਾਹੀਦਾ ਜਾਣਾ ਚਾਹੀਦਾ ਹੈ ਆਪਣਾ ਸੇਫਟੀ ਬਹੁਤ ਜ਼ਰੂਰੀ ਹੈ